ਹਾਂ ਸਾਡਾ ਧਰਮ ਸਰੀਰਿਕ ਸਾਂਭ ਸੰਭਾਲ ਸਿਖਾਉਂਦਾ ਹੈ ਅੰਮ੍ਰਿਤ ਵੇਲੇ ਉੱਠ ਕੇ ਸੈਰ ਸੈਰ ਕਰਨੀ ਕਸਰਤ ਕਰਨੀ ਯੋਗਾ ਕਰਨਾ ਜਿਸ ਨਾਲ਼ ਸਾਡਾ ਸਰੀਰਕ ਤੰਦਰੁਸਤੀ ਅਤੇ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ